ਜੇਕਰ ਅਸੀਂ ਉੱਨੀ ਸੌ ਨੱਬੇ ਜਾਂ ਉਸ ਤੋਂ ਪਹਿਲਾਂ ਜਨਮੇ ਬੰਦਿਆਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਜੀਵਨ ਕਾਲ ਵਿੱਚ ਤੈਕਨੋਲਜੀ ਦੇ ਸਬੰਧਿਤ ਵਿੱਚ ਚਮਤਕਾਰੀ ਤਬਦੀਲੀਆਂ ਹੋਈਆਂ ਹਨ ਇਹ ਉਹ ਜਨਰੇਸ਼ਨ ਹੈ ਜਿਨ੍ਹਾਂ ਨੇ ਉਸ ਤਰ੍ਹਾਂ ਦੇ ਟੈਲੀਵਿਜ਼ਨ ਵੀ ਦੇਖੇ ਹਨ ਜਿਨ੍ਹਾਂ ਦੇ ਉੱਪਰ ਇੱਕ ਲੱਕੜੀ ਦਾ ਸ਼ਟਰ ਲੱਗਿਆ ਹੁੰਦਾ ਸੀ ਅਤੇ ਲੱਕੜੀ ਦੀ ਬਾਡੀ ਹੁੰਦੀ ਸੀ ਅਤੇ ਇਹੀ ਜਨਰੇਸ਼ਨ ਨੇ ਵੱਖ ਵੱਖ ਤਰ੍ਹਾਂ ਦੇ ਟੈਲੀਵਿਜ਼ਨਾਂ ਦੇ ਵਿੱਚ ਤਬਦੀਲੀ ਦੀ ਗੱਲ ਕਰਦੇ ਕਰਦੇ ਕਲਰ ਟੈਲੀਵਿਜ਼ਨ ਅਤੇ ਉਸ ਤੋਂ ਇਲਾਵਾ ਐੱਲ ਸੀ ਡੀ ਟੈਲੀਵਿਜ਼ਨ ਅਤੇ ਅੱਜ ਕੱਲ੍ਹ ਦੇ ਜੋ ਐੱਲ ਈ ਡੀ ਟੈਲੀਵਿਜ਼ਨ ਤੱਕ ਇਹਨਾਂ ਨੇ ਸਫ਼ਰ ਤੈਅ ਕੀਤਾ ਹੈ ਇਸੇ ਤਰ੍ਹਾਂ ਜੇ ਅਗਰ ਆਪਾਂ ਹੋਰ ਤਬਦੀਲੀਆਂ ਦੀ ਗੱਲ ਕਰੀਏ ਇਹ ਉਹ ਜਨਰੇਸ਼ਨ ਹੈ ਜੋ ਟੈਲੀਫੋਨ ਦੀ ਕਾਲ ਕਰਨ ਦੇ ਲਈ ਪੀ ਸੀ ਓ ਜਾਂ ਐੱਸ ਟੀ ਡੀ ਦੇ ਵਿੱਚ ਜਾਂਦੀ ਹੁੰਦੀ ਸੀ ਅਤੇ ਉਹ ਉਹ ਸੀ ਓ ਐੱਸ ਟੀ ਡੀ ਵਾਲੇ ਫ਼ੋਨ ਫਿਰ ਘਰ ਵਿੱਚ ਲੈਂਡਲਾਈਨ ਫ਼ੋਨਾਂ ਵਿੱਚ ਪਰਿਵਰਤਿਤ ਹੋਏ ਉਸ ਤੋਂ ਬਾਅਦ ਵੱਖ ਵੱਖ ਤਰ੍ਹਾਂ ਦੇ ਮੋਬਾਇਲ ਕੰਪਨੀਆਂ ਵੱਲੋਂ ਛੋਟੇ ਛੋਟੇ ਮੋਬਾਇਲ ਫ਼ੋਨ ਜਿਵੇਂ ਕਿ ਨੋਕੀਆ ਗਿਆਰਾਂ ਸੌ ਵਗੈਰਾ ਉਹ ਆਏ ਅਤੇ ਉਹਨਾਂ ਤੋਂ ਇਲਾਵਾ ਫਿਰ ਇਹੀ ਟੈਕਨੋਲਜੀ ਅਗਰ ਆਪਾਂ ਟੈਕਨੋਲਜੀ ਦੀ ਗੱਲ ਕਰੀਏ ਤਾਂ ਉਨ੍ਹਾਂ ਹੀ ਮੋਬਾਇਲ ਫ਼ੋਨਾਂ ਵਿੱਚ ਇੰਟਰਨੈੱਟ ਦੀ ਸਰਵਿਸ ਦੋ ਹਜ਼ਾਰ ਅੱਠ ਨੌ ਦੇ ਕਰੀਬ ਕਾਫ਼ੀ ਚੰਗੀ ਤਰ੍ਹਾਂ ਚੱਲੀ ਜਿਵੇਂ ਕਿ ਟੂ ਜੀ ਇੰਟਰਨੈੱਟ ਸਰਵਿਸ ਬਹੁਤ ਚੱਲੀ ਉਸ ਤੋਂ ਬਾਅਦ ਤਿੰਨ ਥਰੀ ਜੀ ਇੰਟਰਨੈਟ ਵੀ ਕਾਫ਼ੀ ਪਾਪੂਲਰ ਹੋਇਆ ਪ੍ਰੰਤੂ ਜਦੋਂ ਤੋਂ ਦੋ ਹਜ਼ਾਰ ਚੌਦਾਂ ਪੰਦਰਾਂ ਤੋਂ ਫੋਰ ਜੀ ਅਤੇ ਫਿਰ ਫਾਈਵ ਜੀ ਇੰਟਰਨੈੱਟ ਅੱਜ ਕੱਲ੍ਹ ਜੋ ਚੱਲ ਰਿਹਾ ਹੈ ਇਹ ਆਏ ਇਹਨੇ ਕ੍ਰਾਂਤੀਕਾਰੀ ਤਬਦੀਲੀਆਂ ਬ ਮਨੁੱਖਤਾ ਦੇ ਮਨੁੱਖਾਂ ਦੇ ਡੇਲੀ ਜੋ ਸਮਾਜਿਕ ਜੀਵਨ ਦੇ ਵਿੱਚ ਲੈ ਕੇ ਆਉਂਦੀਆਂ ਸੋ ਇਹੀ ਮੁੱਖ ਤਬਦੀਲੀਆਂ ਹਨ ਜਿਨ੍ਹਾਂ ਦੇ ਨਾਲ ਸਾਡੇ ਜੀਵਨ ਦੇ ਵਿੱਚ ਅਤੇ ਸਾਡੇ ਕੰਮ ਦੇ ਵਿੱਚ ਵੱਖ ਵੱਖ ਤਰ੍ਹਾਂ ਨਾਲ ਇਹਨਾਂ ਤੈਕਨਾ ਤੈਕਨੋਲਜੀਆਂ ਨੇ ਸਾਨੂੰ ਪ੍ਰਭਾਵਿਤ ਕੀਤਾ